ਵੈਸੇ ਤਾਂ ਮੈਂ ਆਪ ਹੀ ਕਲਾਕਾਰ ਹਾਂ ਪਰ ਮੇਰਾ ਮਨ ਪਸੰਦ ਕਲਾਕਾਰ ਗੁਰਦਾਸ ਮਾਨ ਜਿਹਨਾਂ ਦੇ ਗੀਤ ਸੱਭਿਆਚਾਰਕ ਅਤੇ ਪਰਿਵਾਰ ਵਿੱਚ ਬੈਠਣ ਕੇ ਸੁਣਨ ਯੋਗ ਹੁੰਦੇ ਹਨ ਮੈਨੂੰ ਉਹਨਾਂ ਦੀ ਗਾਇਕੀ ਅਤੇ ਉਹਨਾਂ ਦਾ ਅੰਦਾਜ਼ ਉਹਨਾਂ ਦੀ ਸਟੇਜ ਪਰਫੋਰਮੈਂਸ ਬਹੁਤ ਵਧੀਆ ਲੱਗਦੀ ਹੈ ਮੈਂ ਚਾਹੁੰਦਾ ਕਿ ਹਰ ਇੱਕ ਕਲਾਕਾਰ ਜਿਹੜਾ ਲੋਕਾਂ ਨੂੰ ਸੇਧ ਦੇ ਸਕੇ ਆਪਣੇ ਗੀਤਾਂ ਰਾਹੀਂ ਆਪਣੇ ਸੱਭਿਆਚਾਰ ਰਾਹੀਂ ਉਹ ਅਜਿਹਾ ਹੋਵੇ ਕਿ ਉਹ ਸਮਾਜ ਦੇ ਵਿਕਾਸ ਲਈ ਕੰਮ ਆ ਸਕੇ ਗੀਤ ਅਤੇ ਲਿਖਣ ਦਾ ਅੰਦਾਜ਼ ਆਪਣੇ ਸੱਭਿਆਚਾਰ ਨੂੰ ਬਹੁਤ ਪ੍ਰਭਾਵਿਤ ਕਰਦਾ ਸਿਆਣੇ ਕਹਿੰਦੇ ਨੇ ਕਿ ਕਿਸੇ ਵੀ ਸੱਭਿਆਚਾਰ ਦੀ ਜਾਂ ਕਿਸੇ ਵੀ ਦੇਸ਼ ਦੀ ਜੇ ਪਛਾਣ ਕਰਨੀ ਹੋਵੇ ਤਾਂ ਉਥੋਂ ਦੇ ਸੱਭਿਆਚਾਰ ਮੁਤਾਬਕ ਪਤਾ ਲੱਗ ਜਾਂਦਾ ਹੈ ਕਿ ਇਹ ਲੋਕ ਕੀ ਚਾਹੁੰਦੇ ਹਨ ਅਤੇ ਕਿਹੋ ਜਿਹਾ ਇਹਨਾਂ ਦਾ ਰਵੱਈਆ ਹੈ ਅਤੇ ਕਿਵੇਂ ਦਾ ਇਹ ਮਾਹੌਲ ਚਾਹੁੰਦੇ ਹਨ ਬਹੁਤ ਹੀ ਕਲਾਕਾਰ ਇਹੋ ਹੀ ਪਏ ਨੇ ਇਹੋ ਜਿਹੇ ਹੁੰਦੇ ਹਨ ਜਿਹੜੇ ਆਪਣੀ ਲੇਖਣੀ ਦੇ ਨਾਲ ਆਪਣੀ ਕਲਾ ਦੇ ਨਾਲ ਆਪਣੀ ਕਲਮ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਦੁਨੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਉਹਨਾਂ ਦਾ ਜਿਹੜਾ ਅੰਦਾਜ਼ ਲੋਕ ਫੋਲੋ ਵੀ ਕਰਦੇ ਹਨ ਅਤੇ ਉਹਨਾਂ ਦੇ ਮਾਰਗ ਦਰਸ਼ਕ ਉਹਨਾਂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲਣਾ ਵੀ ਪਸੰਦ ਕਰਦੇ ਹਨ ਸੋ ਸਾਨੂੰ ਮਿਆਰੀ ਗਾਇਕੀ ਅਤੇ ਮਿਆਰੀ ਲਿਖਣ ਵਿੱਚ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਵਧੀਆ ਲੇਖਣੀ ਹੀ ਸਾਡੇ ਸਮਾਜ ਨੂੰ ਅੱਗੇ ਲਿਜਾ ਸਕਦੀ ਹੈ ਜੇਕਰ ਸਾਡੀ ਲੇਖਣੀ ਦੇ ਵਿੱਚ ਸਾਡੀ ਕਲਾ ਦੇ ਵਿੱਚ ਸਾਡੀ ਪਰਫੋਰਮੈਂਸ ਦੇ ਵਿੱਚ ਕੋਈ ਮਾੜੀ ਚੀਜ਼ ਆ ਜਾਵੇਗੀ ਜਾਂ ਲੇਖਣੀ ਦੇ ਵਿੱਚ ਫਰਕ ਆ ਜਾਵੇਗਾ ਤਾਂ ਉਸ ਦਾ ਸੱਭਿਆਚਾਰ ਵਿਗੜ ਜਾਵੇਗਾ ਸੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਨਰੋਏ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਅਸੀਂ ਚੰਗੀ ਸ਼ਬਦਾਵਲੀ ਅਤੇ ਚੰਗੀ ਲੇਖਣੀ ਦਾ ਪ੍ਰਯੋਗ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਅਤੇ ਆਉਣ ਵਾਲਾ ਸਮਾਜ ਸਾਡੇ ਇਹਨਾਂ ਪੂਰਨਿਆਂ 'ਤੇ ਚੱਲ ਸਕੇ ਅਤੇ ਸਾਡੇ ਦੱਸੇ ਹੋਏ ਰਾਹਾਂ 'ਤੇ ਚੱਲ ਕੇ ਆਪਣੇ ਆਉਣ ਵਾਲੇ ਦੇਸ਼ ਨੂੰ ਖੁਸ਼ਹਾਲ ਕਰ ਸਕੇ ਧੰਨਵਾਦ